ਅੱਜ ਕੱਲ੍ਹ ਦੇ ਇਸ ਮੋਡਰਨ ਜ਼ਮਾਨੇ ਵਿੱਚ ਹਰ ਇੱਕ ਇਨਸਾਨ ਕੋਲ ਆਪਣਾ ਮੋਬਾਈਲ ਫ਼ੋਨ ਹੈ ਜਿਸ ਉੱਤੇ ਇੰਟਰਨੈੱਟ ਦੀ ਸੁਵਿਧਾ ਹੈ ਜਿੱਥੋਂ ਕਿ ਹਰ ਇੱਕ ਇਨਸਾਨ ਆਪਣੇ ਰੁਚੀ ਦੇ ਅਨੁਸਾਰ ਉਸ ਬਾਰੇ ਖੋਜ ਕਰ ਸਕਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕਦਾ ਹੈ ਮੈਂ ਆਪਣੀ ਚਿੱਤਰਕਾਰੀ ਦੀ ਖੋਜ ਲਈ ਮੇ ਮੇਰੇ ਮੂਡ ਦੇ ਅਨੁਸਾਰ ਕੰਮ ਕਰਦੀ ਹਾਂ ਜਦੋਂ ਮੈਂ ਕੁਝ ਵੀ ਘੁੰਮਣਾ ਫਿਰਨਾ ਪਸੰਦ ਕਰਦੀ ਹਾਂ ਤਾਂ ਮੈਂ ਉਹ ਥਾਵਾਂ ਚੁਣਦੀ ਹਾਂ ਜਿੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਚਿੱਤਰਕਾਰੀਆਂ ਹੋਈਆਂ ਹੋਣ ਜਿੱਥੋਂ ਕਿ ਮੈਂ ਆਪਣੀ ਰੁਚੀ ਨੂੰ ਵਧਾ ਸਕਾਂ ਅਤੇ ਉੱਥੋਂ ਕੁਝ ਨਾ ਕੁਝ ਪ੍ਰੇਰਣਾ ਲੈ ਸਕਾਂ ਅਤੇ ਜਦੋਂ ਗੱਲ ਸਮੱਗਰੀ ਇਕੱਠੀ ਕਰਨ ਦੀ ਆਉਂਦੀ ਹੈ ਤਾਂ ਮੈਂ ਆਪਣੀ ਲੋੜ ਦੇ ਅਨੁਸਾਰ ਜੋ ਕਿ ਮੇਰੇ ਏਰੀਏ ਦੇ ਵਿੱਚ ਪੋਸੀਬਲ ਹੁੰਦਾ ਹੈ ਉੱਥੋਂ ਮੈਂ ਆਪਣਾ ਸਮਾਨ ਇਕੱਠਾ ਕਰ ਲੈਂਦੀ ਹਾਂ ਅਤੇ ਜਦੋਂ ਮੈਨੂੰ ਕੁਝ ਨਹੀਂ ਮਿਲਦਾ ਤਾਂ ਇਸ ਨੂੰ ਮੈਂ ਔਨਲਾਈਨ ਔਡਰ ਦੇ ਕੇ ਮੰਗਵਾ ਲੈਂਦੀ ਹਾਂ